ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਤਰਪੇ ਤਰਪੇਸ਼ ਬਿਮਾਰੀਆਂ ਵੱਧ ਰਹੀਆਂ ਹਨ ਅੱਜ ਕੱਲ੍ਹ ਦੇ ਲੋਕਾਂ ਦਾ ਖਾਣ ਪੀਣ ਸਹੀ ਨਾ ਹੋਣ ਕਾਰਨ ਬਹੁਤ ਬਿਮਾਰੀਆਂ ਲੱਗ ਰਹੀਆਂ ਹਨ ਅੱਜ ਕੱਲ੍ਹ ਦੇ ਲੋਕ ਜੋ ਨੈਚੁਰਲ ਖਾਣ ਪੀਣ ਪਹਿ ਪਹਿਨਣ ਨਹੀਂ ਕਰ ਰਹੇ ਤਾਂ ਇਸ ਕਰਕੇ ਦਰਪੇਸ਼ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ ਅੱਜ ਕੱਲ੍ਹ ਲੋਕ ਨੈਚੁਰਲ ਹਵਾ ਨਹੀਂ ਲੈ ਰਹੇ ਏਸੀ ਹਰ ਸੁਬਹਾ ਤੋਂ ਲੈ ਕੇ ਸ਼ਾਮ ਤੱਕ ਸ਼ਾਮ ਤੋਂ ਸ ਸਾਰੀ ਰਾਤ ਤੱਕ ਜੋ ਲੋਕ ਏਸੀ ਏਸੀ ਜੋ ਏਸੀਆਂ ਵਿੱਚ ਰਹਿੰਦੇ ਹਨ ਉਹਨਾਂ ਨੂੰ ਨੈਚੁਰਲ ਹਵਾ ਨਹੀਂ ਨਹੀਂ ਆ ਰਹੀ ਇਸ ਕਰਕੇ ਉਹਨਾਂ ਦਾ ਪਸੀਨਾ ਬਾਹਰ ਨਹੀਂ ਨਿਕਲ ਰਿਹਾ ਜੋ ਕਿ ਉਹਨਾਂ ਦੇ ਰੂਮਸ ਹਨ ਉਹ ਬੰਦ ਹੋ ਚੁੱਕੇ ਹੁੰਦੇ ਹਨ ਅਤੇ ਨੈਚੁਰਲ ਹਵਾ ਕਾਰਨ ਉਹਨਾਂ ਨੂੰ ਉਹ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ ਔਰ ਖਾਣਾ ਪੀਣਾ ਲੋਕ ਅੱਜ ਕੱਲ੍ਹ ਦੇ ਲੋਕ ਫਾਸਟ ਫੂਡ ਵਗੈਰਾ ਬਾਹਰਲਾ ਖਾਣਾ ਤਲਿਆ ਖਾਣਾ ਸਭ ਖਾਂਦੇ ਹਨ ਇਸ ਕਰਕੇ ਉਹ ਤਲਿਆ ਤਲਿਆ ਪਲਿਆ ਖਾਣਾ ਖਾਣ ਨਾਲ ਵੀ ਉਹਨਾਂ ਨੂੰ ਬਹੁਤ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ ਅੱਜ ਕੱਲ੍ਹ ਲੋਕ ਰੇਹਾਂ ਸਪਰੇਹਾਂ ਦੀ ਖੇਤੀ ਕਰਦੇ ਹਨ ਜੋ ਕਿ ਸਾਡੇ ਸਾਡੇ ਅਨਾਜ ਨੂੰ ਬਹੁਤ ਪ੍ਰਭਾਵਿਤ ਕਰਦੇ ਹਨ ਅਨਾਜ ਅਨਾਜ ਖਾਣ ਯੋਗ ਨਹੀਂ ਰਹਿੰਦਾ ਇਸ ਕਰਕੇ ਲੋਕਾਂ ਵਿੱਚ ਬਹੁਤ ਕਮੀਆਂ ਕਮੀਆਂ ਆ ਰਹੀਆਂ ਹਨ ਲੋਕਾਂ ਦਾ ਸਰੀਰ ਬਿਲਕੁਲ ਨਹੀਂ ਹੈ ਅੱਜ ਕੱਲ੍ਹ ਦੇ ਦੁੱਧ ਵਿੱਚ ਵੀ ਕੋਈ ਕੋਈ ਫਾਇਦਾ ਨਹੀਂ ਹੈ ਉਹ ਵੀ ਉਹ ਉਹ ਦੁੱਧ ਵਿੱਚ ਵੀ ਰੇਹਾਂ ਸਪਰੇਹਾਂ ਵਾਲਾ ਨਹੀਂ ਰੇ ਦੁੱਧ ਵੀ ਰੇਹਾਂ ਸਪਰੇਹਾਂ ਵਾਲੇ ਨੀਰੇ ਤੋਂ ਹੀ ਬਣਦਾ ਹੈ ਅੱਜ ਕੱਲ੍ਹ ਖੇਤੀ ਵਿੱਚ ਕੋਈ ਇਨਾ ਫਲ ਫਰੂਟ ਵਿੱਚ ਕੋਈ ਵੀ ਉਹ ਨਹੀਂ ਰੇਹਾਂ ਸਪਰੇਹਾਂ ਦਵਾਈਆਂ ਲਗਾ ਕੇ ਪਕਾਏ ਜਾਂਦੇ ਹਨ ਇਸ ਕਰਕੇ ਲੋਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ ਅਤੇ ਇਹੀ ਹੈ ਕਿ ਅੱਜ ਲੋਕਾਂ ਨੂੰ ਜੋ ਵੀ ਜੋ ਵੀ ਖਾਣਾ ਚਾਹੀਦਾ ਹੈ ਆਪਣੀ ਆਪਣੀ ਸਿਹਤ ਤੰਦਰੁਸਤ ਰੱਖਣ ਲਈ ਹਲਕਾ ਫੁਲਕਾ ਖਾਣਾ ਕਾ ਖਾਣਾ ਚਾਹੀਦਾ ਹੈ ਕੋਈ ਤਲਿਆ ਨਹੀਂ ਖਾਣਾ ਚਾਹੀਦਾ ਬਾਹਰਲਾ ਖਾਣਾ ਤਾਂ ਬਿਲਕੁਲ ਬੰ ਬੰਦ ਕਰ ਦੇਣਾ ਚਾਹੀਦਾ ਹੈ ਲੋ ਬਹੁਤ ਲੋਕ ਆ ਜੋ ਕਿ ਬਾਹਰਲਾ ਖਾਣਾ ਖਾਂਦੇ ਹਨ ਇਸ ਕਰਕੇ ਇਹ ਬਿਮਾਰੀਆਂ ਬਹੁਤ ਲੱਗਦੀਆਂ ਹਨ ਕਿ ਬਾਹਰਲਾ ਖਾਣਾ ਖਾਣ ਨਾਲ ਲੋਕਾਂ ਨੂੰ ਬਹੁਤ ਵੱਡੀਆਂ ਵੱਡੀਆਂ ਬਿਮਾਰੀਆਂ ਲੱਗ ਰਹੀਆਂ ਹਨ ਇਸ ਕਰਕੇ ਲੋਕ ਆਪਣਾ ਬਚਾਵ ਕਰਨ ਲਈ ਵਧੀਆ ਅਤੇ ਘਰ ਦਾ ਬਣਿਆ ਹੀ ਖਾਣਾ ਖਾਣ ਅੱਜ ਕੱਲ੍ਹ ਲੋਕ ਗੈਸ 'ਤੇ ਬਣੀ ਰੋਟੀ ਖਾਂਦੇ ਹਨ ਗੈਸ ਰੋਟੀ ਗੈਸ 'ਤੇ ਡਰੈਕਟ ਰੋਟੀ ਸੇਕਣ ਨਾਲ ਜੋ ਕਿ ਐਲ ਪੀ ਜੀ ਗੈਸ ਹੈਗੀ ਉਹ ਵੀ ਸਾਡੇ ਸਰੀਰ ਨੂੰ ਬਹੁਤ ਨੁਕਸਾਨ ਪਹੁੰਚਾਉਂਦੀ ਹੈ ਇਸ ਲਈ ਸਾਨੂੰ ਸਾਦਾ ਸਿੰਪਲ ਖਾਣਾ ਖਾਣਾ ਚਾਹੀਦਾ ਹੈ ਅਤੇ ਉਹ ਅੱਜ ਕੱਲ੍ਹ ਲੋਕ ਆਪਣੀ ਸਕਿਨ ਨੂੰ ਸਕਿਨ 'ਤੇ ਵੀ ਬਹੁਤ ਜ਼ਿਆਦਾ ਪ੍ਰੋਡਕਟ ਯੂਜ ਕਰ ਰਹੇ ਹਨ ਵਰਤ ਰਹੇ ਹਨ ਇਸ ਕਰਕੇ ਲੋਕਾਂ ਨੂੰ ਲੋਕਾਂ ਦੀ ਸਕਿਨ 'ਤੇ ਵੀ ਬਹੁਤ ਜ਼ਿਆਦਾ ਪ੍ਰਭਾਵ ਪੈ ਰਹੇ ਹਨ ਲੋਕਾਂ ਦੀ ਅੱਜ ਕੱਲ੍ਹ ਲੋਕਾਂ ਦੀ ਸਕਿਨ ਸ ਬਹੁਤ ਨਰਮ ਹੋ ਚੁੱਕੀ ਹੈ ਅਤੇ ਉਹਨਾਂ ਨੂੰ ਕੋਈ ਸਕਿਨ ਬਾਰੇ ਸਕਿਨ ਬਾਰੇ ਅੱਛੇ ਪ੍ਰੋਡਕਟ ਯੂਜ ਕਰਨੇ ਨੈਚੁਰਲ ਪ੍ਰੋਡਕਟ ਯੂਜ ਕਰਨੇ ਚਾਹੀਦੇ ਹਨ ਜਿਵੇਂ ਕਿ ਘਰ ਵਿੱਚ ਸਰ੍ਹੋਂ ਦਾ ਤੇਲ ਹੋਰ ਖੋਪੇ ਦਾ ਤੇਲ ਐਰਾ ਵਗੈਰਾ ਯੂਜ ਕਰਨੇ ਚਾਹੀਦੇ ਹਨ